ਮੇਰਾ ਸਭ ਤੋਂ ਮਨਪਸੰਦ ਗੈਜਟ ਟੈਬ ਟੂ ਹੈ ਜੋ ਰੀਅਲ ਮੀ ਕੰਪਨੀ ਦਾ ਹੈ ਮੈਨੂੰ ਇਹ ਬਹੁਤ ਅੱਛਾ ਲੱਗਦਾ ਹੈ ਕਿਉਂਕਿ ਇਸ ਵਿੱਚ ਮੈਂ ਬਹੁਤ ਕੁਝ ਕਰ ਸਕਦਾ ਹਾਂ ਇੱਕ ਸਭ ਤੋਂ ਵੱਡੀ ਗੱਲ ਮੈਨੂੰ ਇਸ ਤੋਂ ਖੂਬੀ ਲੱਗਦੀ ਕਿ ਇਸਦੀ ਸਕਰੀਨ ਬੜੀ ਵੱਡੀ ਹੈ ਇਸਦੀ ਸਕਰੀਨ ਦੇ ਵਿੱਚ ਮੈਂ ਬਹੁਤ ਅੱਛੀ ਵੀਡੀਓ ਵੀ ਦੇਖ ਸਕਦਾ ਹਾਂ ਕਿਉਂਕਿ ਇੱਕ ਵੀਡੀਓ ਦੇ ਵਿੱਚ ਅੱਛੀ ਕਲੈਰਿਟੀ ਦੇ ਨਾਲ ਬਹੁਤ ਅੱਛਾ ਇੱਕ ਅਨੁਭਵ ਵੀ ਮਿਲਦਾ ਹੈ ਇਸ ਦੇ ਨਾਲ ਨਾਲ ਇਸ ਵਿੱਚ ਮੈਂ ਆਪਣੇ ਕੁਝ ਡਾਟਾ ਵੀ ਸੇਵ ਕਰ ਸਕਦਾ ਹਾਂ ਡਾਟਾ ਸੇਵ ਕਰਨ ਦੇ ਨਾਲ ਨਾਲ ਮੈਂ ਇਸ ਦੇ ਵਿੱਚ ਆਪਣੀ ਹਰ ਪਿਕਚਰਾਂ ਵੀ ਸੇਵ ਕਰ ਸਕਦਾ ਹਾਂ ਇੱਕ ਅੱਛੀ ਤਸਵੀਰ ਜਦੋਂ ਮੈਨੂੰ ਨਜ਼ਰ ਆਉਂਦੀ ਹੈ ਤਾਂ ਮੈਨੂੰ ਬਹੁਤ ਅੱਛਾ ਲੱਗਦਾ ਹੈ ਇਹ ਬਹੁਤ ਹੀ ਅੱਛੀ ਗੈਜਟ ਹੈ ਇਹ ਰੀਅਲਮੀ ਕੰਪਨੀ ਦੀ ਹੈ ਅਤੇ ਰੀਅਲਮੀ ਕੰਪਨੀ ਬਹੁਤ ਅੱਛੀ ਕੰਪਨੀ ਹੈ ਇਸਦੇ ਜਿਤਨੇ ਵੀ ਸਿਫਤ ਕੀਤੀ ਜਾਵੇ ਉਤਨੀ ਹੀ ਘੱਟ ਹੈ ਇਹ ਸਿਫ ਇਹ ਸਿਫਤ ਇਸ ਕਰਕੇ ਮੈਂ ਕਰ ਰਿਹਾ ਹਾਂ ਕਿਉਂਕਿ ਜਦੋਂ ਮੈਂ ਇਸ ਨੂੰ ਚਲਾਉਂਦਾ ਹਾਂ ਅਤੇ ਮੈਨੂੰ ਬਹੁਤ ਹੀ ਅੱਛਾ ਲੱਗਦਾ ਹੈ ਇਸ ਨੂੰ ਚਲਾਉਣ ਦੇ ਨਾਲ ਨਾਲ ਸਭ ਤੋਂ ਵੱਡੀ ਗੱਲ ਮੈਨੂੰ ਇਹ ਲੱਗਦੀ ਹੈ ਕਿ ਇਸਦੀ ਸਕਰੀਨ ਦੂਸਰੀ ਸਕਰੀਨ ਦੇ ਨਾਲੋਂ ਬੜੀ ਹੀ ਵੱਡੀ ਹੈ ਅਤੇ ਜਿੰਨੀਆਂ ਵੀ ਮੈਂ ਵੀਡੀਓ ਇਸਦੇ ਵਿੱਚ ਦੇਖਦਾ ਹਾਂ ਉਹ ਬਹੁਤ ਹੀ ਅੱਛੀਆਂ ਲੱਗਦੀਆਂ ਹਨ ਇੱਕ ਟੈਬ ਦੇ ਵਿੱਚ ਜਿਹੜੀ ਅੱਛੀ ਖੂਬੀ ਹੋਣੀ ਚਾਹੀਦੀ ਹੈ ਉਹ ਇਸ ਟੈਬ ਦੇ ਵਿੱਚ ਮੈਨੂੰ ਮਿਲਦੀ ਹੈ ਕਿਉਂਕਿ ਇਸਦੇ ਨਾਲ ਨਾਲ ਜੀਵਨ ਦੇ ਵਿੱਚ ਜਿਹੜੀਆਂ ਅੱਛੀਆਂ ਮਨਪਸੰਦ ਚੀਜ਼ਾਂ ਤੁਸੀਂ ਦੇਖਣਾ ਚਾਹੁੰਦੇ ਹੋ ਉਹ ਇਸ ਟੈਬ ਦੇ ਵਿੱਚ ਮੈਨੂੰ ਨਜ਼ਰ ਆਉਂਦੀਆਂ ਹਨ ਸੋ ਇਸ ਕਰਕੇ ਇਹ ਮੇਰਾ ਮਨਪਸੰਦ ਗੈਜਟ ਹੈ ਜਿਸਦਾ ਨਾਮ ਰੀਅਲਮੀ ਪੈਡ ਟੂ ਹੈ ਅਤੇ ਇਸ ਵਿੱਚ ਛੇ ਰੈਮ ਦੇ ਨਾਲ ਨਾਲ ਅੱਛੀ ਸਪੇਸ ਵੀ ਮਿਲ ਜਾਂਦੀ ਹੈ ਜੋ ਕਿ ਬਹੁਤ ਹੀ ਅੱਛੀ ਚੀਜ਼ ਹੈ ਇਸ ਕਰਕੇ ਇਹ ਮੇਰਾ ਸਭ ਤੋਂ ਜ਼ਿਆਦਾ ਮਨਪਸੰਦ ਗੈਜਟ ਹੈ